ਹੈਲੋ ਸਤਿ ਸ਼੍ਰੀ ਅਕਾਲ ਮੈਡਮ ਜੀ ਕੀ ਹਾਲ ਚਾਲ ਆ ਠੀਕ ਹੋ ਬੱਚੇ ਠੀਕ ਆ ਘਰ ਪਰਿਵਾਰ ਸਾਰਾ ਠੀਕ ਠਾਕ ਕੀ ਕਰੀ ਜਾਂਦੇ ਸੀਗੇ ਕੀ ਕਰੀ ਜਾਂਦੇ ਹੋ ਅੱਛਾ ਮੈਂ ਤੁਹਾਨੂੰ ਐਂ ਕਹਿੰਦੀ ਸੀ ਮੈਮ ਅਸੀਂ ਨਵੇਂ ਆਏ ਹਾਂ ਅਸੀਂ ਨਵੇਂ ਆਏ ਹੋਏ ਇੱਥੇ ਅਤੇ ਕੋਈ ਸਕੂਲ ਮੈਮ ਬੱਚਿਆਂ ਨੂੰ ਸਕੂਲ ਪਾਉਣਾ ਸੀਗਾ ਸਾਡੇ ਸਾਨੂੰ ਵਧੀਆ ਸਕੂਲ ਬਾਰੇ ਦੱਸਿਆ ਜਾਵੇ ਮੁਕਤਸਰ ਵਿੱਚ ਹਾਂਜੀ

ਹਾਂਜੀ ਮੈਡਮ ਕੁੜੀਆਂ ਵਾਸਤੇ ਕਿਹੜਾ ਸਕੂਲ ਵਧੀਆ ਰਹੇਗਾ ਮੈਡਮ

ਹਾਂਜੀ ਅੱਜ ਕੱਲ੍ਹ ਤਾਂ ਵੈਸੇ ਸਰਕਾਰੀ ਸਕੂਲਾਂ 'ਚ ਵੀ ਬੱਚਿਆਂ ਦਾ ਖਾਣੇ ਦਾ ਸਮਾਂ ਹਾਂਜੀ ਸਰਕਾਰੀ ਸਕੂਲਾਂ 'ਚ ਵੀ ਬਹੁਤ ਜ਼ਿਆਦਾ ਵਧੀਆ ਸਟਡੀਜ਼ ਹੋਣ ਲੱਗ ਗਈ ਅੱਜ ਕੱਲ੍ਹ ਬੱਚੇ ਦਾ ਸ਼ੁਰੂ ਤੋਂ ਲ ਐੱਲ ਕੇ ਜੀ ਤੋਂ ਲੈ ਕੇ ਬਾਹਰਵੀਂ ਤੱਕ ਬਹੁਤ ਵਧੀਆ ਧਿਆਨ ਰੱਖਿਆ ਜਾਂਦਾ ਬੱਚੇ ਸਰਕਾਰੀ ਸਕੂਲਾਂ 'ਚ ਟੀਚਰ ਵੀ ਬਹੁਤ ਵਧੀਆ ਪੜ੍ਹਾਈ ਆ ਠੀਕ ਆ ਹਾਂਜੀ ਹਾਂਜੀ ਫਿਰ ਤੁਸੀਂ ਦੱਸੋ ਸਾਨੂੰ ਵਧੀਆ ਕਿਹੜਾ ਸਕੂਲ ਲੱਗੂ ਫਿਰ ਮੈਂ ਬੱਚਿਆਂ ਦੀ ਅਡਮੀਸ਼ਨ ਕਰਵਾਉਣੀ ਸੀਗੀ ਕੁੜੀਆਂ ਦੀ ਫਿਰ ਮੈਂ ਕੰਨਿਆ ਸਕੂਲ 'ਚ ਕਰਵਾ ਦਾ ਗਰਲ ਸੀਨੀਅਰ ਸੈਕੰਡਰੀ ਸਕੂਲ 'ਚ ਹਾਂਜੀ ਮੈਡਮ ਠੀਕ ਹੈ ਜੀ ਠੀਕ ਹੈ ਮੈਡਮ ਹਾਂਜੀ ਠੀਕ ਚੱਲ ਮੈਂ ਆਪਣੇ ਹਸਬੈਂਡ ਨਾਲ ਗੱਲ ਕਰਦੀ ਫਿਰ ਬੱਚੇ ਨੂੰ ਕਿਹੜੇ ਸਕੂਲ 'ਚ ਲਗਾਉਣਾ ਹਾਂਜੀ ਮੈਡਮ ਠੀਕ ਹੈ ਮੈਡਮ ਚੱਲੋ ਠੀਕ ਹੈ ਮੈਡਮ ਫਿਰ ਚੱਲੋ ਓਕੇ ਮੈਡਮ ਬਾਏ ਮੈਡਮ